ਯੋਗਾ ਸਿੱਖਣ ਲਈ ਮੇਰੇ ਖ਼ਿਆਲ ਦੇ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਕਿਸੇ ਵੀ ਘੱਟ ਤੋਂ ਘੱਟ ਛੋਟੀ ਉਮਰ ਦੇ ਬੱਚੇ ਨੂੰ ਯੋਗਾ ਸਿਖਾਉਣਾ ਸ਼ੁਰੂ ਕੀਤਾ ਜਾ ਜਾਣਾ ਚਾਹੀਦਾ ਹੈ ਜਿੰਨੀ ਛੋਟੀ ਉਮਰ ਵਿੱਚ ਬੱਚਾ ਯੋਗਾ ਸਿੱਖਣਾ ਸ਼ੁਰੂ ਕਰ ਦੇਵੇਗਾ ਵੱਡਾ ਹੋ ਕੇ ਉਹ ਉਸ ਆਦਤ ਦਾ ਧਾਰਨੀ ਹੋ ਜਾਵੇਗਾ ਅਤੇ ਉਹ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਤੰਦਰੁਸਤ ਰੱਖ ਸਕਦਾ ਹੈ ਵੱਡੀ ਉਮਰ ਦੇ ਵਿੱਚ ਯੋਗਾ ਸਿੱਖਣਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਵੱਡੀ ਉਮਰ ਦਾ ਵਿਅਕਤੀ ਯੋਗਾ ਸ਼ੁਰੂ ਕਰਨ ਲਈ ਕਾਫੀ ਕਠਿਨਾਈ ਮਹਿਸੂਸ ਕਰੇਗਾ ਪਹਿਲੀ ਗੱਲ ਤਾਂ ਇਹ ਕਿ ਉਹ ਆਪਣੇ ਆਪ ਨੂੰ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਅ ਨਹੀਂ ਚਲਾ ਸਕਦਾ ਜਾਂ ਉਹ ਆਪਣੇ ਯੋਗਾ ਕਰਨ ਵਾਸਤੇ ਉਹ ਸਮਾਂ ਕੱਢਣਾ ਉਹਦੇ ਲਈ ਮੁਸ਼ਕਿਲ ਹੋ ਜਾਵੇਗਾ ਜੇਕਰ ਛੋਟੀ ਉਮਰ ਤੋਂ ਪੱਕੀ ਆਦਤ ਬਣੀ ਹੋਈ ਹੋ ਹੋਵੇਗੀ ਤਾਂ ਹਰ ਉਮਰ ਦੇ ਵਿੱਚ ਉਹ ਉਹੀ ਜਿਹੜੀ ਅ ਜਿਹੜੀ ਰੁਟੀਨ ਹੈਗੀ ਹੈ ਉਹ ਕੰਮ ਕਰਦੀ ਰਹੂਗੀ ਅਤੇ ਬੱਚਾ ਜਾਂ ਵਿਅਕਤੀ ਆਪਣੇ ਆਪ ਨੂੰ ਹਮੇਸ਼ਾ ਲਈ ਤੰਦਰੁਸਤ ਅਤੇ ਫਿੱਟ ਰੱਖੇਗਾ